ਹੈਲੋ ਮੈਡਮ ਸਰਕਾਰੀ ਹੋਸਪੀਟਲ ਤੋਂ ਬੋਲਦੇ ਆ ਅੱਛਾ ਉਹ ਕਿਸੇ ਨੇ ਮੈਨੂੰ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਇਸ ਹੋਸਪਿਟਲ ਦੇ ਡਾਕਟਰ ਨੂੰ ਮਿਲ ਲਓ ਵਧੀਆ ਦਵਾਈ ਮਿਲਦੇ ਆ ਕਹਿੰਦੇ ਉਰੇ ਉਹ ਮੇਰਾ ਸਿਰ ਬਹੁਤ ਦੁੱਖਦਾ ਸਿਰ ਹਰ ਜਗ੍ਹਾ ਦਵਾਈ ਲੈ ਲਈ ਠੀਕ ਹੀ ਨਹੀਂ ਹੁੰਦਾ ਹਾਂ ਆਪਣੇ ਪਿੰਡੋਂ ਦਵਾਈ ਲਈ ਸੀ ਇੱਕ ਮਹੀਨਾ ਹੋ ਗਿਆ ਹੋਣਾ ਅਲਟਰਾਸਾਊਂਡ ਤਾਂ ਕਰਵਾਇਆ ਨਹੀਂ ਦਵਾਈ ਲਈ ਸੀ ਬਸ ਅੱਛਾ ਛੁੱਟੀ ਕਦੋਂ ਹੁੰਦੀ ਆ ਅੱਛਾ ਫਿਰ ਤੁਸੀਂ ਦੱਸ ਦਿਓ ਕਦੋਂ ਆਉਣਾ ਅਸੀਂ ਬੁਢਲਾਡੇ ਤੋਂ ਹਾਂ ਹਾਂਜੀ ਅੱਛਾ ਜੀ ਅਤੇ ਫੀਸ ਵਗੈਰਾ ਅਤੇ ਫੀਸ ਵਗੈਰਾ ਹਾਂ ਚੱਕਰ ਵੀ ਕਦੇ ਕਦੇ ਆ ਜਾਂਦੇ ਨੇ

ਹੋਰ ਕੋਈ ਟੈਸਟ ਕਰਵਾਇਆ ਨਹੀਂ ਜੀ ਕੋਈ ਨਾ ਜੀ ਆ ਜਾਵਾਂਗੇ ਠੀਕ ਹੈ ਠੀਕ ਕੋਈ ਨਹੀਂ ਧੰਨਵਾਦ ਠੀਕ ਹੈ ਜੀ ਮੇਰਾ ਨਾਮ ਰੂਪਾ ਰਾਣੀ ਬੁਢਲਾਡੇ ਤੋਂ ਠੀਕ ਹੈ ਜੀ ਠੀਕ ਹੈ ਜੀ